ਸਾਡੇ ਇਲਾਕੇ ਦੇ ਲੋਕ ਜਦੋਂ ਚੰ ਅ ਕਰਾਲੀ ਵੱਲ ਨੂੰ ਜਾਂਦੇ ਹਨ ਕੋਈ ਟੈਮ ਨਾਲ ਬੱਸ ਨਹੀਂ ਆਉਂਦੀ ਟੁੱਟੀਆਂ ਸੜਕਾਂ ਕਰਕੇ ਬੱਸਾਂ ਦੀ ਓ ਰੋਕ ਹੋ ਜਾਂਦੀ ਹੈ ਫਿਰ ਬਹੁਤ ਦਿੱਕਤ ਆਉਂਦੀ ਹੈ ਬੰਦਿਆਂ ਨੂੰ ਅਤੇ ਕਾਫੀ ਸੜਕਾਂ ਦਾ ਹਾਲ ਵਿਗੜ ਜਾਂਦਾ ਹੈ ਕੁਛ ਬਰਸਾਤੀ ਪਾਣੀਆਂ ਦੇ ਪਾਣੀ ਅ ਦੇ ਦਿੱਕਤ ਹੋ ਜਾਂਦੀ ਹੈ ਜੀ ਬਹੁਤ ਬੰਦਿਆਂ ਨੂੰ ਤੰਗੀ ਕੱਟਣੀ ਪੈਂਦੀ ਹੈ ਕੋਈ ਸਹੂਲਤ ਵੀ ਹੈ ਨਹੀਂ ਸਾਡੇ ਇਲਾਕੇ ਇੱਧਰ ਅਤੇ ਕਰਾਲੀ ਵੀ ਜਾਣਾ ਹੋਵੇ ਤਾਂ ਵੀ ਟੈਮ ਨਾਲ ਕੋਈ ਕਦੇ ਬੱਸ ਨਹੀਂ ਆਉਂਦੀ ਜੀ ਅਤੇ ਬੰਦੇ ਬੈਠੇ ਰਹਿੰਦੇ ਹਨ ਬੱਸ ਸਟੈਂਡਾਂ 'ਚ ਦੇਖਦੇ ਰਹਿੰਦੇ ਹਨ ਕਾਫੀ ਦਿੱਕਤਾਂ ਇਹ ਸਾਨੂੰ ਸ ਚੁਣੌਤੀਆਂ ਜਿਹੜੀਆਂ ਇਹ ਸਹੂਲਤਾਂ ਦੀ ਜ਼ਰੂਰਤ ਲ ਲੋੜ ਹੈਗੀ ਹੈ ਜੀ ਅਤੇ ਭ੍ਰਿਸ਼ਟਾਚਾਰੀ ਬਹੁ ਬਹੁਤ ਹੈ ਅਤੇ ਬੱਸ ਸਹੂਲਤਾਂ ਦੀ ਬਹੁਤ ਦਿੱਕਤ ਆਉਂਦੀ ਹੈਗੀ ਸੜਕਾਂ ਅਤੇ ਹੋਰ ਨਾਲਿਆਂ ਦੇ ਪੁੱਲ ਵਗੈਰਾ ਵੀ ਟੁੱਟੇ ਹੋਏ ਹਨ ਇਹਨਾਂ ਨੂੰ ਵੀ ਕੋਈ ਮੁਰੰਮਤ ਜਾਂ ਠੀਕ ਨਹੀਂ ਕਰਦਾ ਹੈਗਾ ਅਤੇ ਲੀਡਰਾਂ ਦੇ ਲੀਡਰਾਂ ਤੋਂ ਮੰਗ ਕੀਤੀ ਜਾਂਦੀ ਹੈ ਕੋਈ ਟੈਮ ਨਾਲ ਸੁਣਦੇ ਹੈ ਨਹੀਂ ਹਾਂਜੀ ਕਹਿ ਕੇ ਚਲੇ ਜਾਂਦੇ ਨੇ ਕੰਮ ਨਹੀਂ ਹੁੰਦਾ ਅਤੇ ਬਹੁਤ ਪ੍ਰੋਬਲਮਾਂ ਹੈ ਖੜ੍ਹੀਆਂ ਹੋ ਜਾਂਦੀਆਂ ਹਨ ਜੀ